ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਇੱਥੇ ਸਕੂਲ ਮੈਮ ਸਾਰੇ ਵੈਸੇ ਤਕਰੀਬਨ ਸਾਰੇ ਸਕੂਲ ਬਹੁਤ ਵਧੀਆ ਨੇ ਪਰ ਜਿੱਦਾਂ ਕਿ ਅਕਾਲ ਅਕੈਡਮੀ ਹੋ ਗਈ ਐਨ ਸੀ ਐੱਸ ਹੋ ਗਿਆ ਕਿਡਜੀ ਸਕੂਲ ਹੋ ਗਿਆ ਇਹ ਸਾਰੇ ਸਕੂਲ ਵਧੀਆ ਹਨ ਪਰ ਮੈਂ ਨਾ ਤੁਹਾਨੂੰ ਦੱਸਦੀ ਕਿ ਮੈਂ ਆਪਣੀ ਬੇਟੇ ਦੀ ਐਡਮਿਸ਼ਨ ਨਾ ਅਕਾਲ ਅਕੈਡਮੀ ਕਰਵਾਈ ਆ ਅਤੇ ਮੇਰੀ ਬੇਟੇ ਦਾ ਰਿਜ਼ਲਟ ਪਿਛਲੇ ਸਾਲ ਵੀ ਕਾਫੀ ਵਧੀਆ ਹੀ ਰਿਹਾ ਜਿਹੜੇ ਇੱਥੇ ਨੇ ਪ੍ਰਿੰਸੀਪਲ ਮੈਮ ਨੇ ਬਹੁਤ ਵਧੀਆ ਗਾਈਡ ਕਰਦੇ ਨੇ ਅਤੇ ਇੱਥੇ ਫੀਸ ਸਟਰਕਚਰ ਵੀ ਮੈਡਮ ਮਤਲਬ ਕਿ ਸਹੀ ਸਹੀ ਹੈ ਥਰਟੀ ਥਾਊਸੈਂਡ ਅਰਾਊਂਡ ਬਾਕੀ ਬੁੱਕਸ ਵਗੈਰਾ ਵੀ ਸਹੀ ਲਗਾਈ ਹੋਈ ਉਹਨਾਂ ਨੇ ਕਿ ਕੋਈ ਡਿਫੀਕਲਟ ਨਹੀਂ ਹੈ ਕਿ ਪੇਰੈਂਟਸ ਵੀ ਆਰਾਮ ਨਾਲ ਬੱਚੇ ਨੂੰ ਆਪਣੀ ਸਟੱਡੀ ਕਰਵਾ ਸਕਦਾ ਹੈ ਇੱਦਾਂ ਦੀ ਕਿਉਂ ਕੋਈ ਗੱਲ ਨਹੀਂ ਹੈ ਤੁਸੀਂ ਮਤਲਬ ਕਿ ਮੇਰੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਅਕਾਲ ਅਕੈਡਮੀ ਹੀ ਐਡਮਿਸ਼ਨ ਕਰਾ ਦਿਉ ਅਤੇ ਬੈਟਰ ਹੀ ਰਹੇਗਾ ਤੁਹਾਡਾ ਬੱਚਾ ਮੈਮ ਹਾਂਜੀ ਹਾਂਜੀ ਠੀਕ ਠੀਕ ਠੀਕ ਹੈ ਠੀਕ ਹੈ ਓਕੇ ਮੈਮ ਜ਼ਰੂਰ ਮੈਮ ਓਕੇ ਓਕੇ ਓਕੇ ਓਕੇ ਬਾਏ